ਅੱਜ ਦੇ ਸਮੇਂ ਵਿੱਚ ਹਰ ਇੱਕ ਚੀਜ਼ ਬਹੁਤ ਹੀ ਬਿਹਤਰੀਨ ਢੰਗ ਨਾਲ ਬਣਾਈ ਜਾ ਰਹੀ ਹੈ ਜਿਵੇਂ ਕਿ ਮੋਟਰ ਵਾਹਨ ਇਲੈਕਟਰੋਨਿਕ ਆਈਟਮਸ ਅਤੇ ਹੋਰ ਚੀਜ਼ਾਂ ਆਦਿ ਅੱਜ ਜੋ ਤੁਹਾਨੂੰ ਆਪਣੇ ਪਹਿਲੇ ਪ੍ਰੋਡਕਟ ਬਾਰੇ ਦੱਸਣ ਜਾ ਰਹੀ ਹਾਂ ਉਹ ਇੱਕ ਇਲੈਕਟਰੋਨਿਕ ਆਈਟਮ ਹੈ ਜਿਸ ਦਾ ਨਾਮ ਏਅਰ ਕੰਡੀਸ਼ਨਰ ਹੈ ਇਸਨੂੰ ਆਪਾਂ ਏ ਸੀ ਦੇ ਨਾਮ ਤੋਂ ਵੀ ਜਾਣਦੇ ਹਾਂ ਇਹ ਅੱਜ ਦੇ ਸਮੇਂ ਵਿੱਚ ਹਰ ਘਰ ਵਿੱਚ ਲੱਗਿਆ ਹੋਇਆ ਹੈ ਕੋਈ ਵੀ ਘਰ ਇੱਦਾਂ ਦਾ ਨਹੀਂ ਹੈ ਜਿਸ ਵਿੱਚ ਏ ਸੀ ਨਾ ਲੱਗਿਆ ਹੋਵੇ ਇਸ ਤੋਂ ਅਸੀਂ ਗਰਮੀ ਤੋਂ ਬਚਦੇ ਹਾਂ ਨਾਲ ਨਾਲ ਅਸੀਂ ਆਰਾਮ ਦੀ ਨੀਂਦ ਵੀ ਸੌਂਦੇ ਹਾਂ ਜਦੋਂ ਕੋਈ ਪ੍ਰਾਹੁਣਾ ਆ ਜਾਵੇ ਅਸੀਂ ਸਾਰੇ ਇੱਕੋ ਕਮਰੇ 'ਚ ਸੌਂ ਸਕਦੇ ਹਾਂ ਜਿਸ ਨਾਲ ਅਸੀਂ ਸਾਰੇ ਗੱਲਬਾਤ ਵੀ ਕਰ ਸਕਦੇ ਹਾਂ ਹੋਰ ਜੇ ਗੱਲ ਕੀਤੀ ਜਾਵੇ ਇਹ ਬਿੱਲ ਵੀ ਬਹੁਤ ਘੱਟ ਖਿੱਚਦਾ ਹੈ ਇਹ ਸਾਨੂੰ ਬੜੇ ਆਰਾਮ ਨਾਲ ਤੀਹ ਪੈਂਤੀ ਹਜ਼ਾਰ ਵਿੱਚ ਮਿਲ ਜਾਂਦਾ ਹੈ ਇਹ ਸੀ ਮੇਰਾ ਪਹਿਲੇ ਪ੍ਰੋਡਕਟ ਦਾ ਐਕਸਪੀਰੀਅੰਸ ਜੋ ਕਿ ਮੇਰੇ ਲਈ ਬਹੁਤ ਹੀ ਵਧੀਆ ਸੀ